ਪੰਜਾਬ ਵਿੱਚ ਲੋਕ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਮੀਲ ਪੱਥਰ ਬਣਾਏ ਜਾਂਦੇ ਹਨ ਜਿਵੇਂ ਕਿ ਸੇਵਾ ਮੁਕਤ ਇਸ ਸ ਇਸ ਤਰ੍ਹਾਂ ਇਸ ਵਿੱਚ ਲੋਕ ਆਪਣੇ ਕੰਮਾਂ ਕਾਰਾਂ ਤੋਂ ਸੇਵਾ ਮੁਕਤ ਹੋ ਜਾਂਦੇ ਹਨ ਅਤੇ ਉਹ ਬਹੁਤ ਧੂਮ ਧਾਮ ਨਾਲ ਪਾਰਟੀ ਕਰਦੇ ਹਨ ਅਤੇ ਰਾਤ ਨੂੰ ਡੀ ਜੇ ਵਗੈਰਾ ਵੀ 'ਤੇ ਨੱਚਦੇ ਹਨ ਅਤੇ ਇੱਥੇ ਡਰਿੰਕਸ ਵਗੈਰਾ ਵੀ ਚੱਲਦੇ ਹਨ ਜਿਵੇਂ ਕਿ ਦਾਰੂ ਆਦਿ ਇਹ ਇਸ ਇੱਥੇ ਬਹੁਤ ਵਧੀਆ ਤਰ੍ਹਾਂ ਦੇ ਪ੍ਰੋਗਰਾਮ ਕੀਤਾ ਜਾਂਦਾ ਹੈ ਅਤੇ ਖਾਣ ਪੀਣ ਲਈ ਵੀ ਬਹੁਤ ਵਧੀਆ ਹੁੰਦਾ ਹੈ ਅਤੇ ਲੋਕ ਕੰਮਾਂ ਕਾਰਾਂ ਤੋਂ ਸੇਵਾ ਮੁਕਤ ਹੋ ਜਾਂਦੇ ਹਨ